ਮੈਂ ਟਰੈਕ ਦੇ ਲਈ ਟਰੈਕਿੰਗ ਵਾਸਤੇ ਡਲਹੋਜ਼ੀ ਗਿਆ ਸੀ ਅਤੇ ਡਲਹੋਜ਼ੀ ਦੇ ਵਿੱਚ ਕਾਲਾ ਟੋਪ ਖਜਿਆਰ ਔਰ ਜੋਤ ਦੀ ਟਰੈਕ ਕੀਤੀ ਜੋਤ ਤੋਂ ਉੱਪਰ ਜਦੋਂ ਆਪਾਂ ਗਏ ਸੀਗੇ ਤੋ ਦੂਜਾ ਸਭ ਤੋਂ ਹਾਈਐਸਟ ਪੁਆਇੰਟ ਸੀ ਜਿਹਦੇ ਵਿੱਚ ਦੇਖ ਕੇ ਸਾਨੂੰ ਕਾਫੀ ਅੱਛਾ ਲੱਗਿਆ ਇਹਦੇ ਵਿੱਚ ਸਾਨੂੰ ਦੇਖਣ 'ਚ ਲੱਗਿਆ ਕਿ ਇੱਥੇ ਨਾਗ ਬੂਟੀ ਜੋ ਕਿ ਆਮ ਤੌਰ 'ਤੇ ਸਾਨੂੰ ਦੇਖਣ ਨੂੰ ਨਹੀਂ ਮਿਲਦੀ ਪਰ ਉਸ ਟਰੈਕਿੰਗ ਰੂਟ 'ਤੇ ਸਾਨੂੰ ਨਾਗ ਬੂਟੀ ਮਿਲੀ ਉਹ ਕਾਫੀ ਅਟਰੈਕਸ਼ਨ ਦਾਰ ਸੀਗਾ ਆਪਾਂ ਨੇ ਉਹਦੇ ਪਿਕ ਵੀ ਕਲਿੱਕ ਕੀਤੀ ਅਤੇ ਦਿਖਾਇਆ ਵੀ ਸੀ ਉਹਦੇ ਬਾਰੇ ਆਪਾਂ ਗੱਲਬਾਤ ਵੀ ਕੀਤੀ ਉੱਥੇ ਲੋਕਲ ਅਤੇ ਉਹਨਾਂ ਨੇ ਕਿਹਾ ਸੀ ਘਰ 'ਚ ਨਹੀਂ ਲਗਾ ਸਕਦੇ ਕਿਉਂਕਿ ਘਰ 'ਚ ਸਾਡੇ ਲਗਾਉਣ ਵਾਸਤੇ ਲਿਆਉਣਾ ਸੀਗਾ ਪਰ ਉਹ ਕਹਿੰਦੇ ਕਿ ਐ ਅਟਰੈਕਸ਼ਨਸ ਕਰਦਾ ਸਨੈਕ ਨੂੰ ਜਿਸ ਕਰਕੇ ਘਰ 'ਚ ਵਰਤੋਂ ਇਹਨੂੰ ਲਗਾਇਆ ਨਹੀਂ ਜਾ ਸਕਦਾ ਇਹ ਕਾਫੀ ਮਨਭਾਵਕ ਰਹੀ ਸੀ ਜੋ ਕਿ ਕਾਫੀ ਪ੍ਰਭਾਵਿਤ ਕੀਤਾ ਉਹ ਪਰ ਉਹ ਜਦੋਂ ਗਏ ਸੀ ਉਸ ਤੋਂ ਬਾਅਦ ਆਪਾਂ ਬੱਦਲ ਦੇ ਬਿਲਕੁਲ ਨੇੜੇ ਸੀਗੇ ਟਰੈਕਿੰਗ ਦੇ ਤਾਂ ਉਹ ਵੇਖ ਬੜਾ ਹੀ ਅੱਛਾ ਸਮਾਂ ਸੀਗਾ ਜਿਹਦੇ ਵਿੱਚ ਆਪਾਂ ਨੇ ਘੱਟੋ ਘੱਟ ਉੱਥੇ ਇੱਕ ਦੋ ਘੰਟੇ ਬਿਤਾਇਆ ਅਤੇ ਉੱਥੇ ਆਪਾਂ ਨੇ ਇੰਜੋਏ ਕੀਤਾ ਭੰਗੜੇ ਵੀ ਪਾਏ ਅਤੇ ਕਾਫੀ ਅੱਛਾ ਸੀਗਾ